ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਸਾਈਕੋਲਾਜਿਸਟ ਬੋਲ ਰਹੇ ਹੋ ਹਾਂਜੀ ਮੇਰਾ ਨਾਮ ਸਹਿਜਦੀਪ ਕੌਰ ਹੈ ਅਤੇ ਮੈਂ ਐੱਮ ਏ ਅੰਗਰੇਜ਼ੀ ਕਰ ਰਹੀ ਹਾਂ ਸਾਹਿਤ ਵਿੱਚ ਅਤੇ ਮੈਂ ਤੁਹਾਡੇ ਨਾਲ ਕੁਝ ਗੱਲਾਂ ਦੇ ਲਈ ਰਿਸਰਚ ਕਰਨਾ ਸੀਗਾ ਹਾਂਜੀ ਮੇਰੀ ਕਿਉਂਕਿ ਮਾਸਟਰ ਦੀ ਪੜ੍ਹਾਈ ਦਾ ਆਖਰੀ ਸਾਲ ਚੱਲ ਰਿਹਾ ਅਤੇ ਮੈਂ ਅੱਗੇ ਹੋਰ ਯੂਨੀਵਰਸਿਟੀਆਂ 'ਚ ਵੀ ਅਪਲਾਈ ਕਰਨਾ ਅਤੇ ਅੱਜ ਕੱਲ੍ਹ ਮੇਰੇ ਮਨ 'ਤੇ ਬੜਾ ਭਾਰ ਰਹਿੰਦਾ ਮੇਰਾ ਪੜ੍ਹਾਈ ਵਿੱਚ ਧਿਆਨ ਨਹੀਂ ਲੱਗ ਪਾ ਰਿਹਾ ਅਤੇ ਮੈਤੋਂ ਮੇਰਾ ਕਨਸਨਟਰੇਸ਼ਨ ਧਿਆਨ ਨਹੀਂ ਜੁੜ ਪਾਉਂਦਾ ਪੜ੍ਹਾਈ ਦੇ ਅੰਦਰ ਅਤੇ ਹਰ ਵਕਤ ਭਾਰ ਭਾਰੀ ਭਾਰੀ ਰਹਿੰਦਾ ਮਨ ਜਿੱਦਾਂ ਨੀਂਦ ਆਈ ਜਾਂਦੀ ਆ ਜਾਂ ਫੋਨ 'ਤੇ ਕੁਝ ਵੇਖਣ ਦਾ ਵੀ ਕਰੀ ਜਾਂਦਾ ਜਿਵੇਂ ਕਿਵੇਂ ਕਰਕੇ ਕਿਤਾਬਾਂ 'ਚ ਮਨ ਨਹੀਂ ਲੱਗ ਪਾ ਰਿਹਾ ਹਾਂਜੀ ਮੈਂ ਵੈਸੇ ਤਾਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਸਵੇਰੇ ਸੱਜਰੇ ਉੱਠਾ ਟਾਈਮ 'ਤੇ ਸਮੇਂ 'ਤੇ ਸੌਵਾਂ ਅਤੇ ਸਮੇਂ 'ਤੇ ਜਾਗਾਂ ਅਤੇ ਉੱਠ ਕੇ ਕਸਰਤ ਕਰਾਂ ਬਾਣੀ ਪੜ੍ਹਾਂ ਪਰ ਮੇਤੋਂ ਜੋ ਵੀ ਮੈਂ ਵਿਚਾਰ ਕਰਦੀ ਸੋਚਦੀ ਹਾਂ ਕਿ ਇਦਾਂ ਇਦਾਂ ਕਰਾਂ ਕੁਝ ਵੀ ਹੁੰਦਾ ਨਹੀਂ ਆ ਮੈਂ ਹਮੇਸ਼ਾ ਪਹਿਲਾਂ ਤਾਂ ਲੇਟ ਉਠਦੀ ਹਾਂ ਅਤੇ ਫਿਰ ਭੱਜੀ ਭੱਜੀ ਕੋਲਜ ਜਾਂਦੀ ਆ ਸਾਰਾ ਦਿਨ ਉਥੇ ਨਿਕਲ ਜਾਂਦਾ ਆਖਿਰ ਥੱਕ ਜਾਂਦੀ ਹਾਂ ਥੋੜ੍ਹੀ ਦੇਰ ਸੌਨੀ ਹਾਂ ਪੜ੍ਹਨ ਲੱਗਦੀ ਹਾਂ ਅਤੇ ਪੜ੍ਹਿਆ ਨਹੀਂ ਜਾਂਦਾ ਕੁਝ ਹੋਰ ਕਰ ਲੈਂਦੀ ਹਾਂ ਅਤੇ ਸਮਾਂ ਪਤਾ ਨਹੀਂ ਲੱਗਦਾ ਕਿਦਾਂ ਨਿਕਲ ਜਾਂਦਾ ਕਿ ਇਦਾਂ ਹੀ ਸਮਾਂ ਜਾਈ ਜਾ ਰਿਹਾ

ਹਾਂਜੀ ਮੈਨੂੰ ਬੜਾ ਲਾਭ ਮਿਲਿਆ ਤੁਹਾਡੇ ਨਾਲ ਇਹ ਗੱਲਾਂ ਸਾਂਝੀਆਂ ਕਰਕੇ ਮੈਂ ਦੁਬਾਰਾ ਤੁਹਾਡੇ ਨਾਲ ਇਹ ਗੱਲਾਂ ਜਦੋਂ ਵੀ ਅਗਰ ਮੈਨੂੰ ਕੋਈ ਦਿੱਕਤ ਆਈ ਮੈਂ ਦੁਬਾਰਾ ਫੋਨ ਕਰਕੇ ਤੁਹਾਡੇ ਨਾਲ ਡਿਸਕਸ ਕਰ ਲਵਾਂਗੀ ਧੰਨਵਾਦ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ